ਐਮੀ ਵਿਰਕ ਹ ਅਭਿਨੇਤਾ ਬਹੁਤ ਹੀ ਵਧੀਆ ਅਭਿਨੇਤਾ ਵਾ ਉਹਨਾਂ ਦੀਆਂ ਫਿਲਮਾਂ ਵਿੱਚ ਉਹਨਾਂ ਦਾ ਕਿਰਦਾਰ ਬਹੁਤ ਹੀ ਵਧੀਆ ਹੁੰਦਾ ਵਾ ਅਤੇ ਅਭਿਨੇਤਰੀ ਸਰਗੁਣ ਨੀਰੂ ਬਾਜਵਾ ਸੋਨਮ ਬਾਜਵਾ ਬਹੁਤ ਹੀ ਫਿਲਮਾਂ ਦੇ ਵਿੱਚ ਮਤਲਬ ਕਿ ਆਪਣੀਆਂ ਫਿਲਮਾਂ ਦੇ ਵਿੱਚ ਕਿਰਦਾਰ ਜਿਹੜਾ ਆਪਣਾ ਬਹੁਤ ਸੋਹਣਾ ਨਿਭਾਉਂਦੇ ਹਨ ਸੌਂਕਣ ਸੌਂਕਣੇ ਦੇ ਵਿੱਚ ਉਹ ਮਤਲਬ ਕਿ ਉਹ ਇੱਕ ਦ ਸਰਗੁਣ ਦਾ ਅਤੇ ਨਿਮਰਤ ਖਹਿਰਾ ਦਾ ਮਤਲਬ ਕਿ ਉਹ ਹਸਬੈਂਡ ਹੁੰਦਾ ਵਾ ਅਤੇ ਉਹਦੇ ਵਿੱਚ ਉਹ ਉਹ ਐਮੀ ਵਿਰਕ ਦਾ ਕਿਰਦਾਰ ਬਹੁਤ ਹੀ ਸੋਹਣਾ ਵਾ ਉਹਨਾਂ ਤਿੰਨਾਂ ਨੇ ਬਹੁਤ ਹੀ ਸੋਹਣਾ ਆਪਣਾ ਕਿਰਦਾਰ ਨ ਨ ਕਿਰਦਾਰ ਨਿਭਾਇਆ ਵਾ ਮਤਲਬ ਕਿ ਇਹ ਸੌਂਕਣ ਸੌਂਕਣੇ ਮੂਵੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਅਤੇ ਸਰਗੁਣ ਦਾ ਅਤੇ ਨਿਮਰਤ ਖਹਿਰਾ ਦਾ ਕਿਰਦਾਰ ਬਹੁਤ ਹੀ ਵਧੀਆ ਵਾ ਇਹਦੇ ਵਿੱਚ ਮਤਲਬ ਹਰੇਕ ਚੀਜ਼ ਬਾਰੇ ਦੱਸਿਆ ਗਿਆ ਵਾ ਵੀ ਕਿੱਦਾਂ ਕਿੱਦਾਂ ਸੌਂਕਣਾ ਸੌਂਕਣਾ ਕਰਦੀਆਂ ਵਾ ਕੀ ਕੀ ਹੁੰਦਾ ਵਾ ਅਤੇ ਐਮੀ ਵਿਰਕ ਨੇ ਵੀ ਆਪਣਾ ਕਿਰਦਾਰ ਜਿਹੜਾ ਬਹੁਤ ਹੀ ਵਧੀਆ ਨਿਭਾਇਆ ਵਾ ਉਹਦੇ ਵਿੱਚ ਉਹਨਾਂ ਨੇ ਆਪ ਹਰੇਕ ਚੀਜ਼ ਬਾਰੇ ਉਹਨਾਂ ਨੇ ਪੇਂਡੂ ਵਿਰਸੇ ਬਾਰੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਾਂ ਨੂੰ ਦੱਸਿਆ ਹੋਇਆ ਵਾ ਅਤੇ ਇਹ ਫਿਲਮ ਬਹੁਤ ਹੀ ਵਧੀਆ ਵਾ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਵੇਖੀ ਜਾ ਸਕਦੀ ਇਹਨਾਂ ਦੀਆਂ ਫਿਲਮਾਂ ਕੋਈ ਇਹੋ ਜਿਹੀ ਗੱਲ ਨਹੀਂ ਵੀ ਪਰਿਵਾਰ ਤੋਂ ਬਾਹਰ ਆਪਾਂ ਇਹ ਫਿਲਮਾਂ ਵੇਖ ਸਕਦੇ ਹਾਂ ਇਹਨਾਂ ਅਭਿਨੇਤਾ ਦੀਆਂ ਅਭਿਨੇਤਰੀ ਅਭਿਨੇਤਾ ਦੀਆਂ ਫਿਲਮਾਂ ਬਹੁਤ ਹੀ ਵਧੀਆਂ ਹੁੰਦੀਆਂ ਪਰਿਵਾਰ ਪਰਿਵਾਰਿਕ ਫਿਲਮਾਂ ਹੁੰਦੀਆਂ ਹਨ ਤਾਂ ਵੇਖਣ ਨੂੰ ਹਰੇਕ ਦਾ ਹੀ ਦਿਲ ਕਰਦਾ